ਆਮ ਤੌਰ 'ਤੇ ਅਸੀਂ ਘਰ ਦੀ ਜਿਹੜੀ ਸਬਜ਼ੀ ਰੋਟੀ ਵਗੈਰਾ ਬਣਾਈ ਦੀ ਆ ਉਹ ਅਸੀਂ ਜਾਂ ਤਾਂ ਕੜਾਹੀ 'ਚ ਬਣਾਉਂਦੇ ਹਾਂ ਜਾਂ ਫਿਰ ਅਸੀਂ ਪਤੀਲਿਆਂ 'ਚ ਬਣਾਉਂਦੇ ਹਾਂ ਬਟ ਮੇਰੇ ਕੋਲ ਪ੍ਰੈਸ਼ਰ ਕੁੱਕਰ ਹੈ ਜੋ ਇਸਦੇ ਨਾਲ ਮੈਂ ਬੜੇ ਆਰਾਮ ਦੇ ਨਾਲ ਔਰ ਬੜੀ ਹੀ ਛੇਤੀ ਆਪਣਾ ਘਰ ਆਪਣੀ ਸਬਜ਼ੀ ਵਗੈਰਾ ਬਣਾਉਂਦੀ ਹਾਂ ਇਹਦੀ ਇਹ ਖਾਸੀਅਤ ਹੈ ਕਿ ਇਸਦੇ ਇਸਨੂੰ ਥੋੜ੍ਹਾ ਸਮਾਂ ਵੀ ਲੱਗਦਾ ਹੈ ਔਰ ਚੀਜ਼ ਵੀ ਬਹੁਤ ਵਧੀਆ ਬਣ ਜਾਂਦੀ ਹੈ ਪ੍ਰੈਸ਼ਰ ਕੁੱਕਰ ਨੂੰ ਇਸਤੇਮਾਲ ਕਰਦੇ ਸਮੇਂ ਮੈਂ ਇਹ ਧਿਆਨ ਰੱਖਦੀ ਹਾਂ ਕਿ ਜੇਕਰ ਮੈਂ ਕੋਈ ਦਾਲ ਜਾਂ ਸ ਸਾਗ ਵਗੈਰਾ ਬਣਾ ਰਹੀ ਹਾਂ ਉਹਦੇ ਵਿੱਚ ਮੈਨੂੰ ਕਿੰਨਾਂ ਪਾਣੀ ਚਾਹੀਦਾ ਆ ਕਿੰਨੇ ਉਹਦੇ ਵਿੱਚ ਕਿੰਨੀਆਂ ਸੀਟੀਆਂ ਦਾ ਔਰ ਕਿਸ ਤਰ੍ਹਾਂ ਕਰਨਾ ਚਾਹੀਦਾ ਇਗਜ਼ੈਂਪਲ ਦੇ ਤੌਰ 'ਤੇ ਜੇਕਰ ਮੈਂ ਦਾਲ ਬਣਾ ਰਹੀ ਹਾਂ ਔਰ ਮੇਰੇ ਕੋਲ ਸਮਾਂ ਬਹੁਤ ਘੱਟ ਹੈ ਅਤੇ ਮੈਂ ਦਾਲ ਦੇ ਵਿੱਚ ਉਸ ਹਿਸਾਬ ਨਾਲ ਬੰਦ ਘਰ ਦੇ ਮੈਂਬਰ ਦੇ ਅਕੋਡਿੰਗ ਉਸ ਦਾਲ ਨੂੰ ਬਣਾਉਂਗੀ ਔਰ ਉਹਦੇ ਵਿੱਚ ਉਨੇ ਹੀ ਉਸ ਅਕੋਡਿੰਗ ਪਾਣੀ ਪਾਉਂਗੀ ਜਿੰਨੀ ਮੈਂ ਦਾਲ ਲਊਂਗੀ ਔਰ ਉਸਦਾ ਹਿਸਾਬ ਕਿਤਾਬ ਮੇਰਾ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਹਰ ਇੱਕ ਦਾਲ ਆਪਣਾ ਆਪਣੇ ਲੈਂਦਾ ਏ ਜਿੱਦਾਂ ਮੂੰਗੀ ਧੋਵੀਂ ਦੀ ਦਾਲ ਨੂੰ ਅਸੀਂ ਦੋ ਸੀਟੀਆਂ ਵਜਾ ਦਿੰਦੇ ਹਾਂ ਮਹਾਂ ਦੀ ਦਾਲ ਦੇ ਵਿੱਚ ਅਸੀਂ ਚਾਰ ਪੰਜ ਸੀਟੀਆਂ ਵਜਾਉਂਦੇ ਹਨ ਉਹੀ ਅਸੀਂ ਰਾਜਮਾਂਹ ਬਣਾਈਏ ਤਾਂ ਸਾਡੇ ਪੰਜ ਛੇ ਤੋਂ ਜ਼ਿਆਦਾ ਬਣ ਜਾਂਦੀਆਂ ਹਨ ਇਸੇ ਕਰਕੇ ਇਹ ਬਹੁਤ ਛੇਤੀ ਹੀ ਕੰਮ ਕਰਦਾ ਏ ਆ ਔਰ ਸਾਡੀ ਸਬਜ਼ੀ ਬਹੁਤ ਛੇਤੀ ਘੁਲ ਜਾਂਦੀ ਆ ਔਰ ਬੜੀ ਹੀ ਵਧੀਆ ਬਣ ਜਾਂਦੀ ਆ